ਭੰਗੜਾ ਕਰਨ ਵਾਲੇ ਲੋਕਾਂ ਦਾ ਪਹਿਰਾਵਾ ਕਮੀਜ਼ ਨਾਲ ਚਾਦਰਾ ਪੈਰਾਂ ਵਿੱਚ ਨੋਕੀ ਕੁੰਡੇ ਵਾਲਾ ਜੋੜਾ ਗਲੇ ਵਿੱਚ ਕੈਂਠਾ ਸਿਰ 'ਤੇ ਪੂਛਕੀ ਛਟੀ ਵਾਲੀ ਪਗੜੀ ਬੰਨ੍ਹੀ ਹੁੰਦੀ ਹੈ ਉਹਨਾਂ ਦੇ ਹੱਥਾਂ ਵਿੱਚ ਝੁੰਮਰ ਅਤੇ ਕੰਨਾਂ ਵਿੱਚ ਨੱਤੀਆਂ ਆਦਿ ਪਹਿਰਾਵਾ ਹੁੰਦਾ ਹੈ ਇਹ ਲੋਕ ਇਹ ਅੱਜ ਕੱਲ੍ਹ ਇਸਤਰੀਆਂ ਵੀ ਪਾਉਂਦੀਆਂ ਹਨ ਅਤੇ ਮਰਦ ਵੀ ਪਾਉਂਦੇ ਹਨ ਇਹ ਸਾਡਾ ਪੁਰਾਣਾ ਸੱਭਿਆਚਾਰ ਹੈ ਇਹ ਲੋਕ ਬਹੁਤ ਹੀ ਧੂਮਧਾਮ ਨਾਲ ਪਾਉਂਦੇ ਹਨ ਇਹਨਾਂ ਦੇ ਪਹਿਰਾਵੇ ਨਾਲ ਹੀ ਲੋਕ ਆਕਰਸ਼ਿਕ ਬਣ ਜਾਂਦੇ ਹਨ ਲੋਕ ਇਹਨਾਂ ਨੂੰ ਇਹ ਖੁਸ਼ੀ ਦੇ ਮੌਕੇ 'ਤੇ ਪਾਇਆ ਜਾਂਦਾ ਹੈ ਇਹ ਜ਼ਰੂਰੀ ਨਹੀਂ ਕਿ ਇੱਕ ਮੌਕੇ 'ਤੇ ਪਾਇਆ ਜਾਂਦਾ ਇਹ ਲੋਕ ਵਿਆਹ ਵਿਸਾਖੀ ਵਾਲੇ ਮੇਲੇ 'ਤੇ ਆਦਿ ਹੋਰ ਤਿਉਹਾਰਾਂ 'ਤੇ ਵੀ ਪਾਉਂਦੇ ਹਨ